ਸਤਿ ਸ਼੍ਰੀ ਅਕਾਲ ਜੀ ਟ੍ਰੈਵਲ ਏਜੰਸੀ ਤੋਂ ਬੋਲ ਰਹੇ ਹੋ ਮੈਂ ਪਰਿਵਾਰ ਸਮੇਤ ਛੱਤਬੀੜ ਚਿੜੀਆਘਰ ਜਾਣ ਲਈ ਇੱਕ ਕੈਬ ਬੁੱਕ ਕੀਤੀ ਸੀ ਜੋ ਕਿ ਅੱਜ ਛੇ ਵਜੇ ਸਾਡੇ ਕੋਲ਼ ਹੋਣੀ ਚਾਹੀਦੀ ਸੀ ਪਰੰਤੂ ਅੱਠ ਵਜੇ ਦੇ ਕਰੀਬ ਸਮਾਂ ਹੋ ਗਿਆ ਹੈ ਅਤੇ ਕੈਬ ਹਲੇ ਤੱਕ ਨਹੀਂ ਪਹੁੰਚੀ ਮੈਂ ਸਵੇਰੇ ਤੋਂ ਲਗਾਤਾਰ ਡਰਾਇਵਰ ਨੂੰ ਫ਼ੋਨ ਕਰ ਰਿਹਾ ਹਾਂ ਪਰ ਉਸਦਾ ਫ਼ੋਨ ਬੰਦ ਆ ਰਿਹਾ ਹੈ ਮੇਰੀ ਬੇਨਤੀ ਹੈ ਕਿ ਡਰਾਇਵਰ ਨੂੰ ਫ਼ੋਨ ਨਾ ਚੁੱਕਣ 'ਤੇ ਵਰਜਿਆ ਜਾਵੇ ਅਤੇ ਮੇਰੇ ਦੁਆਰਾ ਕੀਤਾ ਭੁਗਤਾਨ ਮੈਨੂੰ ਵਾਪਸ ਕੀਤਾ ਜਾਵੇ ਜਾਂ ਫਿਰ ਜਲਦੀ ਤੋਂ ਜਲਦੀ ਇੱਕ ਕੈਬ ਜਾਂ ਕੋਈ ਹੋਰ ਕੈਬ ਭੇਜੀ ਜਾਵੇ